ਸਾਡੇ ਘਰਾਂ ਕੋਲ ਸ਼ਹਿਰ ਵਿੱਚ ਇੱਕ ਸ਼ਿਵ ਸ਼ੰਕਰ ਜੀ ਦਾ ਮੰਦਰ ਹੈ ਜਿੱਥੇ ਸ਼ਿਵਰਾਤਰੀ ਬੜੇ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਦੂਰ ਦੂਰ ਤੋਂ ਲੋਕੀ ਸ਼ਿਵਰਾਤਰੀ ਦਾ ਮੇਲਾ ਦੇਖਣ ਜਾਂਦੇ ਹਨ ਉੱਥੇ ਦੁਕਾਨਾਂ ਸਜੀਆਂ ਹੁੰਦੀਆਂ ਹਨ ਮਿਠਿਆਈਆਂ ਦੀਆਂ ਝੂਲਿਆਂ ਦੀਆਂ ਸਾਰੇ ਝੂਲੇ ਲੱਗੇ ਹੁੰਦੇ ਹਨ ਲੋਕ ਲੋਕ ਅਧਿਕ ਗਿਣਤੀ ਵਿੱਚ ਉੱਥੇ ਪਹੁੰਚਦੇ ਹਨ ਸ਼ਿਵਰਾਤਰੀ ਦਾ ਮੇਲਾ ਦੇਖਣ ਲਈ ਉੱਥੇ ਸਾਉਣ ਦੇ ਵਰਤ ਰੱਖਣ ਲਈ ਵੀ ਬਹੁਤ ਗਿਣਤੀ ਵਿੱਚ ਔਰਤਾਂ ਜਾਂਦੀਆਂ ਹਨ ਸਾਵਨ ਦੇ ਵਰਤ ਪੂਜਣ ਲਈ ਉੱਥੇ ਬਹੁਤ ਹੀ ਆਪਣੀਆਂ ਮਨੋਕਾਮਨਾਵਾਂ ਲੈ ਕੇ ਜਾਂਦੇ ਹਨ ਜੋ ਕਿ ਪੂਰਨ ਰੋਹ ਵਿੱਚ ਉਹਨਾਂ ਨੇ ਵਰਤ ਰੱਖ ਕੇ ਜੋ ਮੰਗੀਆਂ ਹੁੰਦੀਆਂ ਹਨ ਉਹਨਾਂ ਦੁਆਰਾ ਆਪਣੀਆਂ ਮਨੋਕਾਮਨਾ ਨੂੰ ਪੂਰਾ ਕੀਤਾ ਜਾਂਦਾ ਹੈ ਉਹਨਾਂ ਦੁਆਰਾ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ ਉਹਨਾਂ ਨੂੰ ਜਲ ਚੜ੍ਹਾਇਆ ਜਾਂਦਾ ਹੈ ਅਧਿਕ ਵਿੱਚ ਕੰਮ ਕੀਤੇ ਜਾਂਦੇ ਹਨ ਅਜਿਹੇ ਕੀਤੇ ਜਾਂਦੇ ਹਨ ਸ਼ਿਵਰਾਤਰੀ ਦੇ ਮੇਲੇ ਵਿੱਚ ਲੋਕ ਬਹੁਤ ਸ਼ਿਵਜੀ ਦਾ ਪੂਜਨ ਕਰਦੇ ਹਨ ਅਤੇ ਆਪਣੀਆਂ ਮਨੋਕਾਮਨਾ ਪੂਰਾ ਹੋਣ ਦੀਆਂ ਇੱਛਾਵਾਂ ਮੰਗਦੇ ਹਨ ਧੰਨਵਾਦ